ਅਸਮਾਨੀ ਬਿਜਲੀ ਕੀ ਹੁੰਦੀ ਹੈ ਅਸਮਾਨੀ ਬਿਜਲੀ ਦੇ ਕਿਵੇਂ ਆਉਂਦੀ ਹੈ ਅਸਮਾਨੀ ਬਿਜਲੀ ਦੇ ਕੀ ਖ਼ਤਰੇ ਹਨ ਛੋਟੇ ਹੁੰਦਿਆਂ ਤੋਂ ਹੀ ਸੁਣਦੇ ਆ ਰਹੇ ਹਾਂ ਜਦੋਂ ਛੋਟੇ ਹੁੰਦੇ ਸੀ ਤਾਂ ਬੜੀ ਜੋਰ ਦੀ ਬਾਰਿਸ਼ ਆਉਂਦੀ ਬੱਦਲ ਗੱਜਦੇ ਅਤੇ ਬਿਜਲੀ ਦੀ ਆਵਾਜ਼ਾਂ ਬਿਜਲੀ ਚਮਕਦੀ ਅਤੇ ਐਂ ਲੱਗਦਾ ਕਿ ਬਿਜਲੀ ਅੱਜ ਕਿਸੇ ਉੱਤੇ ਡਿੱਗ ਪਵੇਗੀ ਤਾਂ ਉਦੋਂ ਘਰ ਦੇ ਕਹਿੰਦੇ ਮਾਤਾ ਕਹਿੰਦੀ ਕਿ ਮਾਮੇ ਅਤੇ ਭਾਣਜੇ ਨੂੰ ਬਿਜਲੀ ਦੇ ਨਾਲ ਬਿਜਲੀ ਜਦੋਂ ਡਿੱਗਦੀ ਇਕੱਠੇ ਨਹੀਂ ਰਹਿਣਾ ਚਾਹੀਦਾ ਜਿਵੇਂ ਜਿਵੇਂ ਵੱਡੇ ਹੋਏ ਇਹਦੇ ਬਾਰੇ ਹੋਰ ਵਿਸਤਾਰ ਨਾਲ ਪਤਾ ਚੱਲਿਆ ਕਿ ਬਿਜਲੀ ਕਿਵੇਂ ਡਿੱਗਦੀ ਹੈ ਤਾਂ ਜ਼ਿਆਦਾਤਰ ਜਦੋਂ ਬੱਦਲ ਆਪਸ ਵਿੱਚ ਟਕਰਾਉਂਦੇ ਹਨ ਤਾਂ ਬਿਜਲੀ ਪੈਦਾ ਹੁੰਦੀ ਹੈ ਬਿਜਲੀ ਡਿੱਗਦੀ ਹੈ ਤਾਂ ਉਦੋਂ ਜਿਹੜੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਹੁੰਦੇ ਹਨ ਜਾਂ ਜੋ ਸੜਕਾਂ ਉੱਤੇ ਪਸ਼ੂ ਰਹਿ ਰਹੇ ਹੁੰਦੇ ਨੇ ਜਾਂ ਜੋ ਰੁੱਖਾਂ ਥੱਲੇ ਖੜ੍ਹੇ ਹੋਏ ਹੁੰਦੇ ਉਹਨਾਂ ਉਤੇ ਬਿਜਲੀ ਦੇ ਡਿੱਗਣ ਦਾ ਖ਼ਤਰਾ ਜ਼ਿਆਦਾ ਬਣਿਆ ਰਹਿੰਦਾ ਇਸ ਕਰਕੇ ਜਦੋਂ ਅਜਿਹਾ ਮੌਸਮ ਹੋਵੇ ਤਾਂ ਉਦੋਂ ਕੀ ਹੈ ਇਸ ਜਗ੍ਹਾ 'ਤੇ ਜਿਹੜਾ ਰੁੱਖਾਂ ਦੇ ਥੱਲੇ ਖੜ੍ਹੇ ਹੋਣ ਤੋਂ ਪਰਹੇਜ਼ ਕਰੋ ਦੂਜੀ ਗੱਲ ਅਗਰ ਤੁਸੀਂ ਘਰ ਦੇ ਅੰਦਰ ਬੈਠੇ ਹੋ ਤਾਂ ਜਦੋਂ ਬਿਜਲੀ ਡਿੱਗਦੀ ਹੈ ਤਾਂ ਕਿਸੇ ਵਰਾਂਡੇ ਵਾਰੀ ਛੱਤ 'ਤੇ ਵਰਾਂਡੇ ਜਿਹਦੀ ਛੱਤ ਮਜਬੂਤ ਹੋਵੇ ਉੱਥੇ ਥੱਲੇ ਰੁਕੋ ਅਗਰ ਤੁਹਾਡੇ ਘਰੇ ਫੋਨ ਦੀ ਵਰਤੋਂ ਤੁਸੀਂ ਕਰ ਰਹੇ ਹੋ ਤਾਂ ਤਾਰਾਂ ਵਾਲੀ ਚੀਜ਼ਾਂ ਨੂੰ ਹੱਥ ਲਾਉਣ ਜਾਂ ਟੀ ਵੀ ਤਾਰਾਂ ਵਾਲੀ ਚੀਜ਼ਾਂ ਨੂੰ ਹੱਥ ਲਾਉਣ ਤੋਂ ਤੁਸੀਂ ਕੀ ਕਰੋ ਪਰਹੇਜ਼ ਕਰੋ ਕਿਉਂਕਿ ਇਹ ਬਿਜਲੀ ਦੀ ਚੀਜ਼ਾਂ ਦੇ ਵਿੱਚ ਇਹ ਜਿਹੜੀ ਅਸਮਾਨੀ ਬਿਜਲੀ ਹੈ ਆ ਜਾਂਦੀ ਹੈ ਜਿਹਦੇ ਕਰਕੇ ਕੀ ਉਹ ਬਿਜਲੀ ਸਾਡੇ ਉੱਤੇ ਅਸਰ ਪਾਉਂਦੀ ਹੈ ਤਾਂ ਕੋਸ਼ਿਸ਼ ਕਰੋ ਕਿ ਕਿਸੇ ਵੀ ਬਿਜਲੀ ਵਾਲੀ ਚੀਜ਼ ਨੂੰ ਹੱਥ ਨਾ ਲਾਓ ਦੂਜੀ ਗੱਲ ਜੋ ਧਾਤੂ ਦੀ ਕੁਚਾਲਕ ਚੀਜ਼ਾਂ ਨੇ ਉਹਨਾਂ ਤੋਂ ਵੀ ਪਰਹੇਜ਼ ਕਰੋ ਤਾਂ ਕਿ ਕੀ ਹੈ ਇਹ ਤੁਹਾਡੇ ਉਤੇ ਕਿਸੇ ਤਰ੍ਹਾਂ ਦਾ ਅਟੈਕ ਨਾ ਕਰੇ ਅਗਰ ਤੁਸੀਂ ਕਿਸੇ ਵਹੀਕਲ ਉੱਤੇ ਸਫ਼ਰ ਕਰ ਰਹੇ ਹੋ ਵਹੀਕਲ ਵਿਚ ਸਫ਼ਰ ਕਰ ਰਹੇ ਹੋ ਤਾਂ ਵਹੀਕਲ ਤੋਂ ਬਾਹਰ ਨਾ ਨਿਕਲੋ ਤਾਂ ਆਪਣੇ ਵਹੀਕਲ ਦੇ ਵਿੱਚ ਹੀ ਬੈਠੇ ਰਹੋ ਅਗਰ ਤੁਹਾਡੇ ਵਹੀਕਲ ਦੀ ਛੱਤ ਮਜਬੂਤ ਹੈ ਤਾਂ ਕੋਸ਼ਿਸ਼ ਕਰੋ ਵਹੀਕਲ ਦੇ ਵਿੱਚ ਹੀ ਰਹੋ ਤਾਂ ਕੀ ਇਹ ਬਿਜਲੀ ਤੁਹਾਡੇ 'ਤੇ ਅਸਰ ਨਹੀਂ ਕਰੇਗੀ ਤਾਂ ਕੋਸ਼ਿਸ਼ ਇਹ ਹੋਏ ਕਿ ਬਿਜਲੀ ਵਾਲੀ ਜਦੋਂ ਬਿਜਲੀ ਚਮਕ ਰਹੀ ਹੈ ਜਾਂ ਬਿਜਲੀ ਗਰਜ ਰਹੀ ਹੈ ਖਾਲੀ ਛੱਤ ਜਾਂ ਖਾਲੀ ਜਗ੍ਹਾ ਦੇ ਉੱਤੇ ਤੁਸੀਂ ਜਾਣ ਤੋਂ ਪਰਹੇਜ਼ ਕਰੋ